ਬੰਦੇ ਨੂੰ ਕੰਮ ਕਰਦਿਆਂ ਬਥੇਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਕੰਮ ਕਰਦਿਆਂ ਸਾਡੇ ਹੀ ਸਾਡੇ ਨਾਲ ਦੇ ਸਾਥੀਆਂ ਨਾਲ ਕਈ ਵਾਰ ਅਣਬਣ ਹੋ ਜਾਂਦੀ ਹੈ ਸਾਨੂੰ ਕਦੇ ਵੀ ਗੁੱਸੇ ਵਿੱਚ ਆ ਕੇ ਆਪਣੇ ਗ਼ਰਮ ਦਿਮਾਗ ਦਾ ਇਸਤੇਮਾਲ ਨਾ ਕ ਨਹੀਂ ਕਰਨਾ ਚਾਹੀਦਾ ਸਗੋਂ ਠੰਡੇ ਦਿਮਾਗ ਨਾਲ ਸੋਚ ਕੇ ਆਪਣੇ ਹਰ ਸ਼ਬਦ ਨੂੰ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਤੋਲ ਕੇ ਅਤੇ ਸੂਝ ਬੂਝ ਦੇ ਨਾਲ ਆਪਣੇ ਹਰ ਸ਼ਬਦ ਨੂੰ ਲੋਕਾਂ ਅੱਗੇ ਪੇਸ਼ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਸ਼ਬਦ ਅਗਲੇ ਦੇ ਲਈ ਕਿਸ ਤਰ੍ਹਾਂ ਅਸਰ ਕਰਨਗੇ ਅਗਲੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਣਗੇ ਇਹ ਅਸੀਂ ਕੁਛ ਨਹੀਂ ਕਹਿ ਸਕਦੇ ਇਸ ਲਈ ਏ ਸਾਨੂੰ ਆਪਣੇ ਕੰਮ ਵਿੱਚ ਆਈਆਂ ਮੁਸ਼ਕਲਾਂ ਨੂੰ ਠੰਡੇ ਦਿਮਾਗ ਨਾਲ ਸੂਝ ਬੂਝ ਨਾਲ ਹੱਲ ਕਰਨਾ ਚਾਹੀਦਾ ਹੈ